ਹਾਂਜੀ ਵਧੀਆ ਹੋਰ ਤੂੰ ਸੁਣਾ ਠੀਕ ਹੈ ਵਧੀਆ ਵਧੀਆ ਵਧੀਆ ਘਰ ਸਭ ਠੀਕ ਠਾਕ ਤੁਸੀਂ ਸੁਣਾਓ ਹੋਰ ਬਸ ਕੰਮ ਤੋਂ ਆਇਆ ਸੀ ਹੁਣੇ ਆ ਕੇ ਬੈਠਾ ਹੀ ਸੀ ਨਾ ਬਸ ਆ ਕੇ ਬੈਠਾ ਸੀ ਹੁਣ ਹੱਥ ਮੂੰਹ ਹੱਥ ਧੋ ਕੇ ਬਸ ਹੁਣ ਰੋਟੀ ਖਾਣ ਦੀ ਤਿਆਰੀ ਕਰਾਂਗੇ ਹੋਰ ਤੂੰ ਸੁਣਾ ਠੀਕ ਠਾਕ ਐਂ ਹੋਰ ਘਰ ਸਭ ਠੀਕ ਠਾਕ ਅੱਛਾ ਕੋਈ ਗੱਲ ਨਹੀਂ ਕਰ ਦਾਂਗੇ ਕੋਈ ਨਹੀਂ ਤੂੰ ਪਤਾ ਕਰ ਅਤੇ ਮੈਂ ਤੈਨੂੰ ਪੈਸਿਆਂ ਦਾ ਅਰੇਂਜ਼ਮੇਂਟ ਕਰ ਦਾਂਗਾ ਤੂੰ ਮੈਨੂੰ ਦੱਸਦੀ ਨਾ ਠੀਕ ਹੈ ਕੋਈ ਗੱਲ ਨਹੀਂ ਸਲਾਹ ਤਾਂ ਕਰ ਲਾਂਗੇ ਚੱਲ ਚੱਲ ਮੈਨੂੰ ਦੱਸਦੀ ਫਿਰ ਮੈਂ ਚੱਲ ਬੜੂਗਾ ਨਾਲ ਕੋਈ ਗੱਲ ਨਹੀਂ ਤੂੰ ਆਪਾਂ ਚੱਲ ਬੜਾਂਗੇ ਨਾਲ ਮੈਂ ਚੱਲ ਬੜੂੰਗਾ ਅਤੇ ਪੈਸੇ ਨੂੰ ਕੋਈ ਨਹੀਂ ਅਰੇਂਜ਼ਮੇਂਟ ਕਰ ਦੂੰਗਾ ਤੂੰ ਮੈਨੂੰ ਦੱਸਦੀ ਠੀਕ ਹੈ ਹੋਰ ਤੂੰ ਟੈਂਸ਼ਨ ਨਾ ਲੈ ਹਮ ਅੱਛ ਅੱਛਾ ਕੋਈ ਗੱਲ ਨਹੀਂ ਤੂੰ ਟੈਂਸ਼ਨ ਨਾ ਲੈ ਪੈਸਿਆਂ ਦਾ ਠੀਕ ਹੈ ਪੈਸਿਆਂ ਦਾ ਅਰੇਂਜ਼ਮੇਂਟ ਕਰ ਦੂੰਗਾ ਮੈਂ ਤੂੰ ਆਪਦੀ ਪੜ੍ਹਾਈ ਕਰ ਠੀਕ ਹੈ ਵਧੀਆ ਵਧੀਆ ਹਮ ਹੋਰ ਖਾਣਾ ਖੂਨਾ ਖਾ ਲਿਆ ਹਮ ਹੋਰ ਕੋਈ ਨਹੀਂ ਤੂੰ ਟੈਂਸ਼ਨ ਨਾ ਲੈ ਠੀਕ ਹੈ ਹੈਗਾ ਤੇਰਾ ਭਰਾ ਹਮ ਕੋਈ ਨਹੀਂ ਪੈਸਿਆਂ ਦਾ ਅਰੇਂਜ਼ਮੇਂਟ ਕਰ ਦੂੰਗਾ ਬਸ ਤੂੰ ਆਪਦੀ ਪੜ੍ਹਾਈ ਕਰ ਠੀਕ ਹੈ ਹੋਰ ਕੀ ਕਰ ਰਹੀ ਐਂ ਹੁਣ ਕੀ ਕਰ ਰਹੀ ਐਂ ਅੱਛਾ ਫ੍ਰੀ ਹੋਰ ਖਾਣਾ ਖੂਨਾ ਖਾ ਲਿਆ ਹਮ ਕੋਈ ਗੱਲ ਨਹੀਂ ਹੈਗਾ ਨਾ ਤੇਰਾ ਭਰਾ ਟੈਂਸ਼ਨ ਨਾ ਲੈ ਹਮ ਹਾਂ ਠੀਕ ਆ ਭੈਣੇ ਬਾਏ